ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਪ੍ਰਭਾਵਸ਼ਾਲੀ ਤਰੀਕਾ ਹੈ ਜ਼ਮੀਨ ਦੇ ਉਪਰਲੀ ਤਹਿ 'ਤੇ ਨਦੀਨਾਂ ਤੋਂ ਛੁਟਕਾਰਾ ਪਾਉਣ ਲਈ ਵਿਛਾਈ ਗਈ ਸ਼ੀਟ ਨੂੰ ਮਲਚ ਕਿਹਾ ਜਾਂਦਾ ਹੈ ਆਮ ਤੌਰ 'ਤੇ ਜ਼ਮੀਨ ਦੀ ਨਮੀਂ ਦੀ ਸਾਂਭ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਿਹਤਰ ਬਣਾਉਣ ਲਈ ਇਸਤੇਮਾਲ ਕੀਤੀ ਜਾਂਦੀ ਹੈ ਮੈਂ ਆਪਣੀ ਬਗੀਚੀ ਵਿੱਚ ਪਰਾਲੀ ਦੀ ਤਹਿ ਵਿਛਾ ਕੇ ਮਲਚਿੰਗ ਕਰਦਾ ਹਾਂ ਮਲਚ ਵਿਛਾਉਣ ਨਾਲ ਕਿ ਬਗੀਚੀ ਦੀ ਦਿੱਖ ਵੀ ਵਧੀਆ ਹੁੰਦੀ ਹੈ ਮਲਚ ਵਿਸ਼ੇਸ਼ ਤੌਰ 'ਤੇ ਕੁਦਰਤੀ ਨਹੀਂ ਹੁੰਦਾ ਇਹ ਸਥਾਈ ਹੋ ਸਕਦੇ ਹਨ ਜਿਵੇਂ ਕਿ ਪਲਾਸਟਿਕ ਦੀ ਸ਼ੀਟ ਰਬੜ ਅਸਥਾਈ ਜਿਵੇਂ ਕਿ ਲੱਕੜ ਦਾ ਬੁਰਾ ਪਰਾਲੀ ਇਹਨਾਂ ਦੀ ਵਰਤੋਂ ਬਗੀਚੀ ਦੀ ਜ਼ਮੀਨ ਉੱਤੇ ਮੌਜੂਦਾ ਪੌਦਿਆਂ ਦੇ ਆਲੇ ਦੁਆਲੇ ਕੀਤੀ ਜਾਂਦੀ ਹੈ ਸੂਰਜ ਦੀਆਂ ਕਿਰਨਾਂ ਅਤੇ ਪਾਣੀ ਕਾਰਨ ਵਾਤਾਵਰਨ ਅਨਕੂਲਿਤ ਜੀਵਿਕ ਸੁਭਾਅ ਅਤੇ ਮਲਚ ਮਿੱਟੀ ਜਿਹਦੇ ਵਿੱਚ ਮਿਲ ਜਾਂਦੇ ਹਨ ਅਤੇ ਨਦੀਨਾਂ ਤੋਂ ਛੁਟਕਾਰਾ ਪਾਉਣ ਲਈ ਮਲਚ ਕਾਫੀ ਲਾਭਦਾਇਕ ਹੁੰਦੀ ਹੈ ਸਥਾਈ ਤੌਰ 'ਤੇ ਲੱਕੜੀ 'ਤੇ ਬੁਰਾ ਮਲਚ ਤੌਰ 'ਤੇ ਵੀ ਵਰਤਿਆ ਜਾਂਦਾ ਹੈ ਪਰ ਸਮਾਂ ਪੈਣ 'ਤੇ ਇਹ ਸਿਓਂਕ ਲੱਗ ਜਾਂਦੀ ਹੈ ਇਸਦਾ ਖਰਾਬ ਹੁੰਦਾ ਇਸ ਲਈ ਮੈਂ ਆਪਣੀ ਬਗੀਚੀ ਵਿੱਚ ਮਲਚਿੰਗ ਲਈ ਪਰਾਲੀ ਦੀ ਵਰਤੋਂ ਕਰਦਾ ਹਾਂ ਜਿਸ ਨਾਲ ਕਿ ਪੌਦਿਆਂ ਵਿੱਚ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਪੌਦਿਆਂ ਦਾ ਵੀ ਵਾਧਾ ਵੀ ਬਹੁਤ ਵਧੀਆ ਹੁੰਦਾ ਹੈ ਪਰਾਲੀ ਨਾਲ ਬਣਾਏ ਗਏ ਸੰਘਣੇ ਮੈਲ ਦੀ ਵਿਛਾਈ ਨਾਲ ਚੂਹਿਆਂ ਦਾ ਅੰਦਰ ਜਾਣਾ ਮੁਸ਼ਕਿਲ ਹੁੰਦਾ ਹੈ ਇਸ ਤਰੀਕੇ ਨਾਲ ਨਦੀਨਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਨਦੀਨਾਂ ਦੀ ਰੋਕਥਾਮ ਅਤੇ ਪਰਾਲੀ ਦੀ ਸੰਭਾਲ ਦੀ ਚੁਣੌਤੀਆਂ ਨੂੰ ਦੇਖਦੇ ਹੋਏ ਵਿਗਿਆਨ ਵਿਭਾਗ ਮਨਿਸਟਰੀ ਸਾਇੰਸ ਕਾਲਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਲਈ ਮਲਚ ਮੈਟ ਬਣਾਏ ਗਏ ਹਨ ਇਹ ਮਲਚ ਮੈਟ ਦੇ ਤਰੀਕੇ ਨਾਲ ਬਣਾਏ ਗਏ ਹਨ